ਪਟਿਆਲਾ ਜੋ ਸ਼ਹਿਰ ਹੈ ਇੱਕ ਵਿਰਾਸਤੀ ਸ਼ਹਿਰ ਹੈ ਇੱਕ ਰੋਇਲ ਸਿਟੀ ਹੈ ਪਟਿਆਲਾ ਤਾਂ ਇਹਦੇ ਵਿੱਚ ਜਿਹੜਾ ਹੈ ਮੇਨ ਤਾਂ ਇੱਕ ਪਟਿਆਲੇ ਦਾ ਹੈਰੀਟੇਜ਼ ਮੇਲਾ ਲੱਗਦਾ ਹੈਰੀਟੇਜ਼ ਫੈਸਟੀਵਲ ਲੱਗਦਾ ਹਰ ਸਾਲ ਤਾਂ ਉਹ ਸਰਦੀਆਂ ਦੇ ਵਿੱਚ ਹੈਰੀਟੇਜ਼ ਜਿਹੜਾ ਹੈ ਫੈਸਟੀਵਲ ਲੱਗਦਾ ਪਟਿਆਲੇ ਵਿੱਚ ਜਿਹੜੇ ਮੇਨ ਮੇਨ ਕਰਾਫਟਸ ਨੇ ਕਰਾਫਟ ਮੇਲਾ ਲੱਗਦਾ ਗਾ ਉਹ ਜੀ ਜਿਵੇਂ ਇੱਥੇ ਦਿਖਾਇਆ ਜਾਂਦਾ ਤਾਂ ਉਹ ਵੀ ਇੱਕ ਮੇਨ ਸੱਭਿਆਚਾਰਕ ਤਿਉਹਾਰ ਹੈ ਪਟਿਆਲੇ ਦਾ ਇਸ ਤੋਂ ਇਲਾਵਾ ਪਟਿਆਲੇ ਜਿਹੜੇ ਗੁਰਪੁਰਬ ਨੇ ਇੱਥੇ ਗੁਰੂਆਂ ਦੀ ਨਗਰੀ ਹੈ ਪਟਿਆਲਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧਿਤ ਗੁਰਦੁਆਰਾ ਸਾਹਿਬ ਨੇ ਦੁੱਖ ਵਨਾ ਸਾਹ ਦੂਖਨਿਵਾਰਨ ਸਾਹਿਬ ਗੁਰਦੁਆਰਾ ਹੈ ਜਾਂ ਬਹਾਦਰਗੜ੍ਹ ਪਟਿਆਲੇ ਦੇ ਵਿੱਚ ਹੀ ਪੈਂਦਾ ਉੱਥੇ ਗੁਰਦੁਆਰਾ ਸਾਹਿਬ ਹੈ ਤਾਂ ਉੱਥੇ ਜਿਹੜੇ ਉਹ ਗੁਰਪੁਰਬ ਨੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਪੁਰਬ ਵਗੈਰਾ ਇੱਥੇ ਮਨਾਏ ਜਾਂਦੇ ਹਨ